ਮੇਰੇ ਦੁਆਰਾ ਪੜ੍ਹੀ ਗਈ ਆਖ਼ਰੀ ਕਿਤਾਬ ਜਿਹਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਰਿੱਚ ਡੈਡ ਪੂਅਰ ਡੈਡ ਹੈ ਜੋ ਕਿ ਮੈਂ ਪਿਛਲੇ ਦਿਨੀਂ ਪੜ੍ਹੀ ਹੈ ਕੁਝ ਦਿਨ ਹੀ ਹੋਏ ਹਲੇ ਉਹਨੂੰ ਪੜ੍ਹੀ ਨੂੰ ਅਤੇ ਉਹਨੇ ਅਸਲ 'ਚ ਬਹੁਤ ਪ੍ਰਭਾਵਿਤ ਕੀਤਾ ਮੈਨੂੰ ਕਿਉਂਕਿ ਉਹਦੇ ਤੋਂ ਮੈਨੂੰ ਸਿੱਖਣਾ ਮਿਲਿਆ ਵੀ ਪੈਸਾ ਚੱਲਦਾ ਕਿਵੇਂ ਹੈ ਅਸਲ 'ਚ ਵੀ ਪੈਸੇ ਤੋਂ ਪੈਸਾ ਬਣਾਉਣਾ ਕਿਵੇਂ ਹੈ ਪੈਸੇ ਨੂੰ ਖਰਚਣਾ ਕਿਵੇਂ ਹੈ ਜੇ ਬੰਦਾ ਇਹ ਚੀਜ਼ਾਂ ਸਿੱਖ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਵੇ ਤਾਂ ਉਹ ਬੰਦਾ ਕਦੇ ਗਰੀਬ ਨਹੀਂ ਰਹਿ ਸਕਦਾ ਕਿਉਂਕਿ ਜੇ ਆਪਾਂ ਅੱਜ ਦੀ ਤਰੀਕ 'ਚ ਥੋੜ੍ਹਾਂ ਜਿਹਾ ਪੈਸਾ ਵੀ ਕਮਾਉਂਦੇ ਹੈ ਪਰ ਉਹ ਆਪਾਂ ਸਹੀ ਤਰੀਕੇ ਨਾਲ ਲਗਾ ਨਹੀਂ ਪਾਉਂਦੇ ਤਾਂ ਬੰਦੇ ਉਹ ਜਿਹੇ ਜਿਹਾ ਕਮਾਇਆ ਨਾ ਕਮਾਇਆ ਇੱਕ ਬਰਾਬਰ ਹੈ ਉਹ ਆਉਂਦਾ ਹੈ ਅਤੇ ਚਲਿਆ ਜਾਂਦਾ ਹੈ ਪਰ ਜੇ ਆਪਾਂ ਪੈਸਾ ਕਮਾਉਂਦੇ ਹਾਂ ਅਤੇ ਉਹਨੂੰ ਸਹੀ ਜਗ੍ਹਾ ਲਗਾਉਂਦੇ ਹਾਂ ਜਿੱਥੋਂ ਹੋਰ ਪੈਸਾ ਆਵੇਗਾ ਸੋ ਇੱਕ ਤਰੀਕੇ ਨਾਲ ਆਪਾਂ ਪੈਸਾ ਬੀਜ ਹੀ ਦਿੰਦੇ ਹਾਂ ਉਹ ਸੋ ਇਹ ਚੀਜ਼ਾਂ ਸਿੱਖਣ ਨੂੰ ਮਿਲੀਆਂ ਜਿਹੜੀਆਂ ਕਿ ਮੈਨੂੰ ਲੱਗਦਾ ਹੈ ਵੀ ਆਉਂਦੇ ਸਮੇਂ ਦੇ ਵਿੱਚ ਮੇਰੀ ਜ਼ਿੰਦਗੀ 'ਚ ਵੀ ਜ਼ਰੂਰ ਕੰਮ ਆਉਣਗੀਆਂ ਅਤੇ ਮੈਂ ਇਹ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਐਕਸਪੀਰੀਐਂਸ ਵੀ ਕਰ ਰਿਹਾ ਅਤੇ ਜਾਣੀ ਕਿ ਕੋਸ਼ਿਸ਼ ਕਰ ਰਿਹਾ ਵੀ ਜੋ ਕੁਝ ਮੈਂ ਉਹ ਕਿਤਾਬ 'ਚ ਪੜ੍ਹਿਆ ਉਂਵੇ ਉਂਵੇ ਹੁਣ ਆਪਣੀ ਜ਼ਿੰਦਗੀ 'ਚ ਚੱਲਾਂ ਅਤੇ ਉਹ ਚੀਜ਼ਾਂ ਪਰਤਿਆ ਕੇ ਦੇਖਾ ਵੀ ਅਸਲ ਦੇ ਵਿੱਚ ਹੁੰਦਾ ਵੀ ਉੱਦਾਂ ਹੀ ਹੈ ਜਾਂ ਨਹੀਂ ਬਾਕੀ ਉਮੀਦ ਤਾਂ ਮੈਨੂੰ ਪੂਰੀ ਹੈ ਵੀ ਇਹ ਚੀਜ਼ਾਂ ਮੇਰੀ ਜ਼ਿੰਦਗੀ ਬਦਲਣਗੀਆਂ ਬਾਕੀ ਦੇਖੋ ਅੱਜ ਨਹੀਂ ਤਾਂ ਕੱਲ੍ਹ ਹੌਲੀ ਹੌਲੀ ਪਰ ਬਦਲਾਵ ਜ਼ਰੂਰ ਆਵੇਗਾ